ਭਾਰਤ ਦੇ ਵਿੱਚ ਸਰਕਾਰ ਵੱਲੋਂ ਬਹੁਤ ਹੀ ਜ਼ਿਆਦਾ ਸਕੀਮਾਂ ਜਿਹੜੀਆਂ ਚਲਾਈਆਂ ਜਾਂਦੀਆਂ ਹਨ ਬਹੁਤ ਨਾਲ ਕਈ ਕਈ ਵਧੀਆ ਵੀ ਹੁੰਦੀਆਂ ਹਨ ਉਸ ਦੇ ਵਿੱਚ ਇੱਕ ਜਿਹੜੀ ਪੰਜ ਲੱਖ ਵਾਲੀ ਸਕੀਮ ਚਲਾਈ ਗਈ ਸੀਗੀ ਭਾਰਤ ਯੋਜਨਾ ਹੇਠ ਚਲਾਈ ਗਈ ਹੈਗੀ ਉਹਦੇ ਵਿੱਚ ਤਾਂ ਉਸ ਨਾਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਲਾਭ ਹੋਇਆ ਗਾ ਉਸ ਸਕੀਮ ਦੇ ਨਾਲ ਅਸੀਂ ਜਿਹੜੇ ਦਾਦਾ ਜੀ ਦੇ ਗੋਡੇ ਪਵਾਏ ਸੀਗੇ ਤਾਂ ਉਸ ਵਿੱਚ ਸਾਡਾ ਕੋਈ ਵੀ ਖਰਚਾ ਨਹੀਂ ਆਇਆ ਹੈਗਾ ਜਿਹੜਾ ਇਹ ਪੰਜ ਲੱਖ ਵਾਲਾ ਕਾਰਡ ਹੈਗਾ ਇਹ ਸਰਕਾਰੀ ਸਰਕਾਰੀ ਜਿਹੜੇ ਹਸਪਤਾਲਾਂ ਵਿੱਚ ਵੀ ਚੱਲਦਾ ਹੈਗਾ ਅਤੇ ਪ੍ਰਾਈਵੇਟ ਕਈ ਕਈ ਹਸਪਤਾਲਾਂ ਦੇ ਵਿੱਚ ਵੀ ਚੱਲ ਜਾਂਦਾ ਹੈਗਾ ਤਾਂ ਜਿਸ ਕਾਰਨ ਵੀ ਅਸੀਂ ਇਹ ਗੋਡਾ ਵੀ ਪਵਾਇਆ ਸੀਗਾ ਤਾਂ ਉਸ ਦੇ ਵਿੱਚ ਸਾਡਾ ਇੱਕ ਰੁਪਇਆ ਵੀ ਖਰਚ ਨਹੀਂ ਹੋਇਆ ਹੈਗਾ ਜਿਸ ਕਰਕੇ ਸਾਡੀ ਕੋਈ ਭਕਾਈ ਨਹੀਂ ਹੋਈ ਕੋਈ ਛੁੱਟੀ ਲੈਣ ਲੋੜ ਨਹੀਂ ਪਈ ਗੀ ਵਧੀਆ ਗਏ ਅਤੇ ਅਸੀਂ ਵਧੀਆ ਗੋਡਾ ਪਵਾ ਕੇ ਆ ਗਏ ਸੀਗੇ ਜਿਸ ਕਰਕੇ ਸਾਡੀ ਭਕਾਈ ਨਹੀਂ ਹੋਈ ਗੀ ਅਤੇ ਨਾਲ ਅਤੇ ਨਾ ਸਾਡਾ ਕੋਈ ਖਰਚਾ ਹੋਇਆ ਹੈਗਾ ਅਤੇ ਸਾਰਾ ਖਰਚਾ ਹੀ ਉਸ ਜਿਹੜੀ ਯੋਜਨਾ ਸੀ ਉਹਦੇ ਵਿੱਚੋਂ ਹੀ ਕੱਟਿਆ ਗਿਆ ਸੀਗਾ ਅਤੇ ਜਿਸ ਕਰਕੇ ਉਹ ਜਿਹੜੀ ਯੋਜਨਾ ਹੈਗੀ ਉਸਦਾ ਕੱਟਿਆ ਗਿਆ ਸੀਗਾ ਤਾਂ ਇਸ ਜਿਹੜੇ ਪੰਜ ਲੱਖ ਦੇ ਕਾਰਡ ਦੀ ਯੋਜਨਾ ਉਹਨਾਂ ਨੇ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈਗੀ ਤਾਂ ਇਹ ਜਿਹੜੇ ਗਰੀਬ ਜਨਤਾ ਦੇ ਵਾਸਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੈਗੀ ਜਿਹੜਾ ਕਿ ਉਹ ਵਧੀਆ ਇਸ ਦਾ ਫਾਇਦਾ ਚੁੱਕ ਸਕਦੇ ਹਨ ਵੀ ਜਿਹੜੇ ਹਿਸਾਬ ਨਾਲ ਵੀ ਉਹ ਕੋਈ ਇਲਾਜ ਨਹੀਂ ਕਰਵਾ ਸਕਦੇ ਕੋਈ ਉਹਨਾਂ ਦਾ ਵੱਡਾ ਇਲਾਜ ਹੈਗਾ ਵੀ ਉਹਨਾਂ ਤੋਂ ਨਹੀਂ ਕਰਵਾਇਆ ਜਾਂਦਾ ਤਾਂ ਉਹ ਇਹਨਾਂ ਦੀ ਸਹਾਇਤਾ ਨਾਲ ਵਧੀਆ ਕਰਵਾ ਸਕਦੇ ਹਨ ਇਸ ਕਰਕੇ ਸਰਕਾਰ ਦੀ ਜਿਹੜੀ ਇਹ ਸਕੀਮ ਹੈਗੀ ਬਹੁਤ ਹੀ ਲਾਹੇਵੰਦ ਹੈਗੀ ਜਿਹੜਾ ਕਿ ਗਰੀਬ ਜਨਤਾ ਨੂੰ ਗਰੀਬ ਸੰਖਿਆ ਦੀ ਜਨਤਾ ਨੂੰ ਬਹੁਤ ਹੀ ਜ਼ਿਆਦਾ ਲਾਭ ਹੈਗਾ ਇਸ ਸਕੀਮ ਦਾ ਥੈਂਕ ਯੂ